ਮੈਨੇ ਬਚਪਨ ਤੋਂ ਹੀ ਚਿੱਤਰਕਾਰੀ ਕਰਨੀ ਸ਼ੁਰੂ ਕਰ ਦਿੱਤੀ ਸੀ ਚਿੱਤਰਕਾਰੀ ਮੈਨੂੰ ਬਹੁਤ ਚੰਗੀ ਲੱਗਦੀ ਹੈ ਚਿੱਤਰ ਬਣਾਉਣਾ ਮੈਨੂੰ ਬਹੁਤ ਚੰਗਾ ਲੱਗਦਾ ਚਿੱਤਰਾਂ ਵਿੱਚ ਰੰਗ ਭਰਨਾ ਮੇਰੇ ਦਿਲ ਨੂੰ ਸਕੂਨ ਦਿੰਦਾ ਹੈ ਜੋ ਕਿ ਮੈਨੂੰ ਬਹੁਤ ਚੰਗਾ ਲੱਗਦਾ ਹੈ ਚਿੱਤਰ ਨਾਲ ਮੈਂ ਹਰ ਇੱਕ ਚੀਜ ਨੂੰ ਆਪਣੇ ਹੱਥਾਂ ਨਾਲ ਛਾਪ ਸਕਦੀ ਹਾਂ ਚਿੱਤਰਕਾਰੀ ਲਈ ਮੈਨੂੰ ਬਹੁਤ ਸਾਰੀ ਦਿਲਚਸਪ ਚੀਜਾਂ ਮਿਲਦੀਆਂ ਹਨ ਜਿਵੇਂ ਕਿ ਪਹਾੜੀਆਂ ਫੁੱਲ ਬਾਗ ਬਗੀਚੇ ਸਕੂਲ ਬਿਲਡਿੰਗਾਂ ਆਦਿ ਬਹੁਤ ਕੁਛ ਮਿਲਦਾ ਹੈ ਇਹਨਾਂ ਸਭ ਨੂੰ ਦੇਖ ਕੇ ਹੀ ਮੈਨੂੰ ਚਿੱਤਰਕਾਰੀ ਕਰਨ ਨੂੰ ਦਿਲਚਸਪੀ ਪੈਦਾ ਹੁੰਦੀ ਹੈ ਇੱਕ ਵਾਰੀ ਮੈਂ ਆਪਣੇ ਘਰਦਿਆਂ ਨਾਲ ਹਿਮਾਚਲ ਵਿੱਚ ਘੁੰਮਣ ਗਈ ਸੀ ਤਾਂ ਉੱਥੇ ਦੀਆਂ ਪਹਾੜੀਆਂ ਅਤੇ ਬਾਗ ਬਗੀਚਿਆਂ ਨਾ ਨੂੰ ਦੇਖ ਕੇ ਮੇਰਾ ਮਨ ਬਹੁਤ ਖੁਸ਼ ਹੋਇਆ ਜਿਸ ਕਾਰਨ ਮੈਨੂੰ ਚਿੱਤਰਕਾਰੀ ਕਰਨ ਵਿੱਚ ਬਹੁਤ ਦਿਲਚਸਪੀ ਪ੍ਰਾਪਤ ਹੋਈ ਮੈਨੇ ਉੱਥੇ ਚਿੱਤਰਕਾਰੀ ਬਣਾਈ ਮੈਨੇ ਉੱਥੇ ਹਿਮਾਚਲ ਦੇ ਪਰਬਤਾਂ ਦੀ ਚਿੱਤਰਕਾਰੀ ਬਣਾਈ ਇਹ ਚਿੱਤਰਕਾਰੀ ਬਹੁਤ ਹੀ ਸੁੰਦਰ ਸੀ ਇਹਨਾਂ ਵਿੱਚ ਰੰਗ ਭਰ ਕੇ ਮੈਨੂੰ ਬਹੁਤ ਚੰਗਾ ਲੱਗਿਆ ਅਤੇ ਇਹ ਬਹੁਤ ਹੀ ਸੁੰਦਰ ਦਿਖਾਈ ਦੇ ਰਹੇ ਸੀ ਮੇਰਾ ਮਨਪਸੰਦ ਕਲਾਕਾਰ ਹੁਸੈਨ ਹੈ ਇਹ ਇੱਕ ਪਾਕਿਸਤਾਨੀ ਕਲਾਕਾਰ ਹੈ ਇਸ ਦੀ ਕਲਾਕਾਰੀ ਬਹੁਤ ਹੀ ਚੰਗੀ ਅਤੇ ਮਹਾਨ ਹੈ ਇਹ ਬਹੁਤ ਅੱਛੀ ਚਿੱਤਰਕਾਰੀ ਬਣਾਉਂਦਾ ਹੈ ਅਤੇ ਸਭ ਨੂੰ ਇਹ ਚਿੱਤਰਕਾਰੀ ਬੜੀ ਚੰਗੀ ਲੱਗਦੀ ਹੈ ਇਹ ਸਭ ਕੁਛ ਵੇਖ ਕੇ ਚਿੱਤਰਕਾਰੀ ਵਿੱਚ ਬੜਾ ਮਨ ਲੱਗਦਾ ਹੈ